ਜਦੋਂ ਵੀ ਅਸੀਂ ਕਿਸੇ ਵੀ ਲੰਬੇ ਸਫਰ 'ਤੇ ਬਾਈਕ 'ਤੇ ਜਾਣਾ ਹੈਗਾ ਆ ਅਤੇ ਸਾਨੂੰ ਕੀ ਹੈਗਾ ਉਹਦੀ ਤਿਆਰੀ ਥੋੜ੍ਹੀ ਪਹਿਲਾਂ ਕਰ ਦੇਣੀ ਚਾਹੀਦੀ ਹੈਗੀ ਹੈ ਅਤੇ ਉਹਦੇ ਲਈ ਕੀ ਹੈਗਾ ਆ ਤੁਹਾਡੀ ਥੋੜ੍ਹੀ ਜਿਹੀ ਰੂਟੀਨ ਦੇ 'ਚ ਅ ਐਕਸਰਸਾਈਜ ਕਰਦੇ ਰਹਾਂਗੇ ਅਤੇ ਉਹਦੇ ਨਾਲ ਸਾਡੀ ਜਿਹੜੀ ਪਿੱਠ ਦਰਦ ਬਾਹਵਾਂ ਜਾਂ ਮੋਢੇ ਦਰਦ ਦੀ ਜਿਹੜੀ ਹੈਗੀ ਆ ਪ੍ਰੋਬਲਮ ਨਹੀਂ ਆਏਗੀ ਕਿਉਂਕਿ ਆਪਾਂ ਲੰਬੇ ਰੂਟ ਦੇ ਉੱਤੇ ਜਾਣਾ ਹੈਗਾ ਆ ਦੂਜਾ ਜਦੋਂ ਵੀ ਅਸੀਂ ਲੰਬੇ ਸਫਰ 'ਤੇ ਜਾਣਾ ਹੈਗਾ ਆ ਅਤੇ ਰਸਤੇ ਵਿੱਚ ਜਦੋਂ ਵੀ ਅਸੀਂ ਕਿਤੇ ਬਰੇਕ ਲੈਣੀ ਹੈਗੀ ਆ ਖਾਣਾ ਖਾਣ ਦੇ ਲਈ ਰੈਸਟ ਕਰਨੀ ਹੈਗੀ ਆ ਜਦੋਂ ਖਾਣਾ ਖਾਣਾ ਖਾਣਾ ਘੱਟ ਕੁਆਂਟਿਟੀ 'ਚ ਖਾਣਾ ਆ ਪਰ ਉਹ ਨਿਊਟਰੀਸੀਅਸ ਹੋਣਾ ਚਾਹੀਦਾ ਹੈਗਾ ਹੁਣ ਫੋਰ ਇੰਗਜੈਪਲ ਜਿੱਦਾਂ ਅਸੀਂ ਲੰਬੇ ਰੂਟ 'ਤੇ ਹਾਈ ਓਲਟੀਟਿਊਡ 'ਤੇ ਜਾਣਾ ਹੈਗਾ ਅਤੇ ਆਪਣੇ ਕੋਲ ਜਿਹੜਾ ਹੈਗਾ ਰੂਟੀਨ ਦੇ ਵਿੱਚ ਆਪਣੇ ਕੋਲ ਜਿਹੜੀਆਂ ਹੈਗੀਆਂ ਨੇ ਚਿੰਗਮ ਜ਼ਰੂਰ ਰੱਖਣੀ ਹੈਗੀ ਹੈ ਉਹਦੇ ਨਾਲ ਕੀ ਹੈਗਾ ਤੁਹਾਨੂੰ ਪਿਆਸ ਘੱਟ ਲੱਗਦੀ ਹੈਗੀ ਹੈ ਪਲਸ ਤੁਹਾਡੇ ਜਿਹੜੀ ਬਰੀਦਿੰਗ ਹੈਗੀ ਉਹਦੇ ਨਾਲ ਨੋਰਮਲ ਰਹਿੰਦੀ ਹੈਗੀ ਆ ਇਹਦੇ ਨਾਲ ਤੁਹਾਡਾ ਜਿਹੜਾ ਹੈਗਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਾਹ ਲੈਣ ਦੇ ਵਿੱਚ ਪ੍ਰੋਬਲਮ ਪਿਆਸ ਦੇ ਕਰਕੇ ਕੋਈ ਪ੍ਰੋਬਲਮ ਜਿਹੜੀ ਹੈਗੀ ਉਹ ਕਰੀਏਟ ਨਹੀਂ ਹੁੰਦੀ ਹੈਗੀ ਅਤੇ ਪਹਿਲਾਂ ਤਿਆਰੀ ਕੀਤੀ ਜ਼ਿਆਦਾ ਵਧੀਆ ਰਹਿੰਦੀ ਹੈਗੀ ਹੈ ਮਹੀਨਾ ਪਹਿਲਾਂ ਫੋਰ ਇੰਗਜੈਪਲ ਜੇ ਅਗਰ ਲੇਹ ਲਦਾਖ ਦਾ ਰੂਟ ਹੈਗਾ ਇੱਥੋਂ ਤਕਰੀਬਨ ਸਾਢੇ ਪੰਜ ਸੌ ਕਿਲੋਮੀਟਰ ਦੇ ਦੂਰ ਹੈਗਾ ਸਾਡੇ ਆਹ ਜਲੰਧਰ ਏਰੀਏ ਤੋਂ ਅਤੇ ਉਹਦੇ ਵਾਸਤੇ ਜਿਹੜੇ ਸਾਡੇ ਸਟੋਪ ਪੁਆਇੰਟ ਹੈਗੇ ਨੇ ਸਾਨੂੰ ਪਹਿਲਾਂ ਹੀ ਆਡੈਂਟੀਫਾਈ ਕਰ ਲੈਣੇ ਚਾਹੀਦੇ ਹੈਗੇ ਨੇ ਉਹਦੇ ਨਾਲ ਕੀ ਹੈਗਾ ਰਾਹ ਦੇ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਿਹਤ ਦੇ ਰਿਲੇਟਡ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਅਗਰ ਸਾਨੂੰ ਪਹਿਲਾਂ ਪਤਾ ਹੋਵੇ ਫੇਰ ਅਸੀਂ ਸਟੋਪੇਜ ਲੈਣਾ ਕਿਹੜੇ ਟਾਈਮ 'ਤੇ ਖਾਣਾ ਖਾਣਾ ਕਿਹੜੇ ਟਾਈਮ 'ਤੇ ਅਸੀਂ ਪਾਣੀ ਵਗੈਰਾ ਜਾਂ ਆਪਣੇ ਡ੍ਰਿੰਕਸ ਵਗੈਰਾ ਲੈਣੀਆਂ ਹੈਗੀਆਂ ਨੇ ਉਹਦੇ ਨਾਲ ਯਾਤਰਾ ਜਿਹੜੀ ਹੈਗੀ ਸੁਖਾਲੀ ਰਹਿੰਦੀ ਹੈਗੀ ਆ ਧੰਨਵਾਦ ਜੀ